ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਕੋਹਲੀ ਸਵੀਟਸ ਤੋਂ ਗੱਲ ਕਰਦੇ ਹੋ ਮੈਂ ਗੈਰੀ ਗੱਲ ਕਰ ਰਿਹਾ ਹਾਂ ਅਤੇ ਮੈਂ ਤੁਹਾਨੂੰ ਇੰਝ ਪੁੱਛਣਾ ਸੀ ਵੀ ਅੱਜ ਦੇ ਮੈਨਿਊ ਵਿੱਚ ਕੀ ਕੁਝ ਸਪੈਸ਼ਲ ਹੈ ਜੀ ਕੀ ਛੋਲੇ ਭਟੂਰੇ ਠੀਕ ਹੈ ਫਿਰ ਐਦਾਂ ਕਰਿਓ ਚਾਰ ਪਲੇਟਾਂ ਛੋਲੇ ਭਟੂਰਿਆਂ ਦੀਆਂ ਪੈਕ ਕਰ ਦਿਓ ਅਤੇ ਨਾਲ ਹੀ ਮੈਂ ਇਹ ਪੁੱਛਣਾ ਸੀ ਤੁਹਾਡੇ ਮਿੱਠੇ ਵਿੱਚ ਕੀ ਖ਼ਾਸ ਹੈ ਜੀ ਐਦਾਂ ਕਰਿਓ ਦੋ ਪਲੇਟਾਂ ਗੁ ਗਰਮ ਗੁਲਾਬ ਜਾਮਣਾਂ ਦੀਆਂ ਪੈਕ ਕਰ ਦਿਓ ਮੈਂ ਤੁਹਾਡੇ ਬਾਰੇ ਮੇਰੇ ਦੋਸਤਾਂ ਤੋਂ ਬਹੁਤ ਹੀ ਜ਼ਿਆਦਾ ਸੁਣਿਆ ਹੈ ਕਿ ਵੀ ਤੁਹਾਡਾ ਖਾਣਾ ਬਹੁਤ ਹੀ ਸ ਸਵਾਦ ਹੁੰਦਾ ਹੈ ਅਤੇ ਕਿਰਪਾ ਕਰਕੇ ਐਦਾਂ ਵੀ ਕਰਿਓ ਮੇਰਾ ਔਡਰ ਦੋ ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਦਾ ਕਰ ਦਿਓ ਕਿਉਂਕਿ ਮੇਰੇ ਦੋਸਤ ਨਾਭੇ ਤੋਂ ਆ ਆਏ ਹਨ ਅਤੇ ਉਹਨਾਂ ਨੇ ਜਲਦ ਹੀ ਆਪਣੇ ਵਾਪਸ ਘਰ ਜਾਣਾ ਹੈ ਅਤੇ ਐਦਾਂ ਵੀ ਕਰਿਓ ਚਾਰ ਗਲਾਸ ਡਿਸਪੋਜਲ ਅਤੇ ਚਾਰ ਕੌਲੀਆਂ ਵੀ ਨਾਲ ਹੀ ਪੈਕ ਕਰ ਦਿਓ